ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਾਡੇ ਕੋਲ ਦੋ ਹਜ਼ਾਰ ਚੋਦ੍ਹਾਂ ਵੀ ਖੜ੍ਹੀ ਦੋ ਹਜ਼ਾਰ ਸੋਲ੍ਹਾਂ ਵੀ ਖੜ੍ਹੀ ਹੈ ਬਾਰ੍ਹਾਂ ਵੀ ਖੜ੍ਹੀ ਹੈ ਵੀਹ ਵੀ ਖੜ੍ਹੀ ਹੈ ਦੱਸੋ ਤੁਸੀਂ ਕਿਹੜੀ ਚਾਹੀਦੀ ਤੁਹਾਨੂੰ ਹਾਂਜੀ ਹਾਂਜੀ ਦੋ ਹਜ਼ਾਰ ਸੋਲ੍ਹਾਂ ਮੋਡਲ ਸਕਾਰਪੀਓ ਖੜ੍ਹੀ ਹੈ ਜੀ

ਪਚਾਸੀ ਹਜ਼ਾਰ ਚੱਲੀ ਹੋਈ ਹੈ ਜੀ ਹਾਂਜੀ ਸਾਢੇ ਛੇ ਲੱਖ ਜੀ ਸਕਾਰਪੀਓ ਦੋ ਹਜ਼ਾਰ ਉੱਨ੍ਹੀ ਹਾਂ ਉੱਨ੍ਹੀ ਮਾਡਲ ਖੜ੍ਹੀ ਹੈ ਆਪਣੇ ਕੋਲ ਸਕਾਰਪੀਓ ਓਰ ਚੱਲੀ ਪਚਵੰਜਾ ਹਜ਼ਾਰ ਚੱਲੀ ਹੋਈ ਹੈ ਉਹ ਅਤੇ ਉਹਦਾ ਰੇਟ ਸਾਢੇ ਨੌ ਲੱਖ ਰੁਪਈਆ ਏ ਹਾਂਜੀ ਹਾਂਜੀ ਸਾਰਾ ਕੁਛ ਜੈਨੂਅਨ ਹੈ ਸਾਰਾ ਕੁਛ ਹੋਇਆ ਹੋਇਆ ਤੁਸੀਂ ਆਪਣਾ ਮਕੈਨਿਕ ਵੀ ਨਾਲ ਲਿਆ ਸਕਦੇ ਹੋ ਔਰ ਦੇਖ ਵੀ ਸਕਦੇ ਚੈੱਕ ਵੀ ਕਰ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਸਭ ਕੁਛ ਜੈਨੁਅਨ ਹੈ ਕੋਈ ਮਤਲਬ ਕਿ ਪੁੱਠਾ ਕੰਮ ਨਹੀਂ ਹੈਗਾ ਜੀ ਹਾਂਜੀ ਹਾਂਜੀ ਹਾਂਜੀ ਫਸਟ ਓਨਰ ਗੱਡੀ ਇਹ ਸੀਟ ਕਵਰ ਪਏ ਹੋਏ ਹੈ ਸਿਸਟਮ ਲੱਗਿਆ ਸਾਰਾ ਕੁਝ ਲੱਗਿਆ ਹੋਇਆ ਜੀ ਹਾਂਜੀ ਕਰਵਾਏ ਸਭ ਕੁਛ ਓਕੇ ਹੈ ਜੀ ਸਿਸਟਮ ਲਵਾਏ ਜੀ ਸੀਟ ਕਵਰ ਮੈਟ ਸਭ ਕੁਛ ਹੋਇਆ ਜੀ ਵਾਈਟ ਕਲਰ ਮਾ ਖੜ੍ਹੀ ਹੈ ਜੀ ਗੱਡੀ ਇਹ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਕੁਛ ਹੈਗਾ ਤੁਸੀਂ ਮੈਨੂੰ ਦੱਸ ਦਿਓ ਪੈਮੇਂਟ ਕਰ ਦਿਓ ਗੱਡੀ ਤੁਹਾਨੂੰ ਡਿਲੀਵਰ ਕਰ ਦੂੰਗੇ ਆ ਜਾਣੀਆਂ ਵਟਸਐਪ ਦੇ ਉੱਪਰ ਫੋਟੋਆਂ ਭੇਜ ਰਿਹਾਂ ਮੈਨੂੰ ਵਟਸਐਪ ਨੰਬਰ ਦੱਸ ਦਿਓ ਮੈਂ ਫੋਟੋਆਂ ਭੇਜ ਦੂੰਗਾ ਓਕੇ ਜੀ ਓਕੇ ਠੀਕ ਹੈ ਜੀ